ਹੈਲੋ ਹਾਂਜੀ ਮੈਂ ਅੰਮ੍ਰਿਤ ਕੌਰ ਬੋਲਦੀ ਹਾਂ ਜੀ ਤੁਸੀਂ ਫਲਿਪਕਾਟ ਕੰਪਨੀ ਤੋਂ ਬੋਲਦੇ ਹੋ ਹਾਂਜੀ ਸਰ ਸਰ ਮੇਰਾ ਬੇਟਾ ਸੈਵਨ ਸਟੈਂਡਰਡ ਵਿੱਚ ਪੜ੍ਹਦਾ ਹੈ ਔਰ ਉਸਨੂੰ ਨਾ ਲੈਪਟੋਪ ਦੀ ਜ਼ਰੂਰਤ ਸੀਗੀ ਉਹਦੇ ਕੁਛ ਫਰੈਂਡਸ ਨੇ ਔ ਔਨਲਾਈਨ ਔਡਰ ਕੀਤਾ ਸੀਗਾ ਫਲਿਪਕਾਟ ਤੋਂ ਹੀ ਔਰ ਉਹਨਾਂ ਦੇ ਮਤਲਬ ਲੈਪਟਾਪ ਦੇਖ ਕੇ ਮੇਰਾ ਬੇਟਾ ਵੀ ਜ਼ਿੱਦ ਕਰਨ ਲੱਗ ਗਿਆ ਕਿ ਮੈਂ ਔਨਲਾਈਨ ਹੀ ਮੰਗਵਾਉਣਾ ਔਰ ਮੈਨੂੰ ਔਨਲਾਈਨ ਸ਼ੋਪਿੰਗ ਪਸੰਦ ਨਹੀਂ ਸੀਗੀ ਮੈਨੂੰ ਇਹ ਹੁੰਦਾ ਸੀਗਾ ਕਿ ਸ਼ਾਇਦ ਔਨਲਾਈਨ ਚੀਜ਼ ਵ ਨਹੀਂ ਵਧੀਆ ਆਉਂਦੀ ਔਰ ਟਾਈਮ 'ਤੇ ਨਹੀਂ ਆਉਂਦੀ ਅਤੇ ਲੇਕਿਨ ਤੁਹਾਡਾ ਔ ਔਡਰ ਬਹੁਤ ਵਧੀਆ ਟਾਈਮ 'ਤੇ ਔਰ ਉਹਦੇ ਫੀਚਰਸ ਵੀ ਇੰਨੇ ਵਧੀਆ ਉਹਦਾ ਕਲਰ ਮੈਨੂੰ ਬਹੁਤ ਪਸੰਦ ਆਇਆ ਜਿੱਦਾਂ ਦਾ ਮਤਲਬ ਮੈਂ ਚਾਹੁੰਦੀ ਸੀਗੀ ਉੱਦਾਂ ਦਾ ਹੀ ਮਿਲ ਗਿਆ ਬਹੁਤ ਵਧੀਆ ਮੈਨੂੰ ਲੱਗਿਆ ਔਰ ਮੈਨੂੰ ਸ਼ੋਪਿੰਗ ਕਰਕੇ ਵੀ ਬਹੁਤ ਵਧੀਆ ਲੱਗਿਆ ਕਿ ਹਾਂ ਨਹੀਂ ਠੀਕ ਆ ਔਨਲਾਈਨ ਸ਼ੋਪਿੰਗ ਵਧੀਆ ਹੁੰਦੀ ਆ ਔਰ ਮੈਂ ਅੱਗੇ ਤੋਂ ਵੀ ਅਗਰ ਕੁਛ ਮੰਗਵਾਉਣਾ ਹੋਇਆ ਤਾਂ ਮੈਂ ਔਨਲਾਈਨ ਫਲਿਪਕਾਟ ਤੋਂ ਹੀ ਮੰਗਵਾਵਾਂਗੀ ਮੈਨੂੰ ਬਹੁਤ ਵਧੀਆ ਲੱਗਿਆ ਕਿ ਮੈਂ ਤੁਹਾਡੇ ਔਨਲਾਈਨ ਸ਼ਾਪਿੰਗ ਕੀਤੀ ਔਰ ਮੈਨੂੰ ਲੈਪਟੋਪ ਬਹੁਤ ਪਸੰਦ ਆਇਆ ਥੈਂਕ ਯੂ ਜੀ